ਹੈਲੋ ਵਧੀਆ ਵਧੀਆ ਤੂੰ ਸੁਣਾ

ਅੱਛਾ ਉਹ ਆਪਾਂ ਐਡਮੀਸ਼ਨ ਤਾਂ ਹੁਣ ਕਰਾ ਲਈ ਇੱਥੇ ਹੈ ਨਾ ਆ ਯਾਰ ਹੋਸਟਲ ਦਾ ਯਾਰ ਊਂ ਵੀ ਖਾਣਾ ਪੀਣਾ ਤੈਨੂੰ ਪਤਾ ਵਧੀਆ ਤਾਂ ਹੁੰਦਾ ਨਹੀਂ ਹੈਗਾ ਹੈ ਨਾ ਤਾਂ ਵੀ ਆਪਾਂ ਇੰਨੀ ਫੀਸ ਵਗੈਰਾ ਵੀ ਬਹੁਤ ਜ਼ਿਆਦਾ ਹੋਵੇਗੀ ਮੰਨਥ ਸਮੈਸਟਰ ਦੀ ਅਤੇ ਆਪਾਂ ਖਾਣਾ ਪੀਣਾ ਤਾਂ ਇੰਨਾਂ ਹੁੰਦਾ ਨਹੀਂ ਹੈਗਾ ਅਤੇ ਫਾਲਤੂ ਹੀ ਖਰਚਾ ਆਪਣਾ ਆਪਾਂ ਫਿਰ ਕਿਤੇ ਨੇੜੇ ਤੇੜੇ ਨੇੜੇ ਤੇੜੇ ਪੀਜੀ ਦੇਖ ਲੈਂਦੇ ਆ ਕਿਤੇ ਹੈ ਨਾ ਜਿਹੜਾ ਆਪਣਾ ਜ਼ਿਆਦਾ ਦੂਰ ਵੀ ਨਾ ਹੋਵੇ ਅਤੇ ਮੋਟਰਸਾਈਕਲ ਮੋਟਰਸਾਈਕਲ ਦੀ ਲੋੜ ਵੀ ਨਾ ਪਵੇ ਨੇੜੇ ਦੇਖ ਲੈਂਦੇ ਹਾਂ ਨਾਲੇ ਰੋਟੀ ਪਾਣੀ ਆਪਣੀ ਹੋ ਜੂਗੀ ਨਹੀਂ ਘਰ ਦੀ ਰੋਟੀ ਮਿਲ ਜੂਗੀ ਉੱਥੇ ਕਿਸੇ ਨਾਲ ਗੱਲ ਕਰ ਲਾਂਗੇ ਟਿਫਨ ਵਗੈਰਾ ਲਾ ਲਾਂਗੇ ਹਮ ਨਾਲੇ ਪੈਸੇ ਬਚਣਗੇ ਚਾਰ ਨਾਲੇ ਵਾਈਫਾਈ ਵੂਈਫਾਈ ਦੀ ਕੋਈ ਦਿੱਕਤ ਨਹੀਂ ਹੋਣੀ ਉੱਥੇ ਹੈਂ ਕਮਰੇ ਵੀ ਵਧੀਆ ਆਪਣੇ ਖੁੱਲ੍ਹੇ ਇੰਡੀ ਇੰਡੀਪੈਂਡਡ ਇੰਡੀਪੈਂਡਡ ਹੋਵੇਗਾ ਕੰਮ ਜੋ ਮਰਜ਼ੀ ਕਰਿਓ ਜਿੱਥੇ ਮਰਜ਼ੀ ਹੈ ਨਾ ਹੁਣ ਇੱਥੇ ਤੈਨੂੰ ਪਤਾ ਹੀ ਆ ਹੋਸਟਲ 'ਚ ਮੁੰਡੇ ਲੜਾਈ ਪੜਾਈ ਸੌ ਗੱਲਾਂ ਹੋ ਜਾਂਦੀਆਂ ਹਮ ਪੜ੍ਹਾਈ ਪੜੂਈ ਤਾਂ ਫਿਰ ਕਿੱਥੇ ਹੁੰਦੀ ਹੋਸਟਲ 'ਚ ਇੱਥੇ ਲੈ ਕੇ ਬਾਹਰ ਦੇਖ ਲੈਂਦੇ ਨੇੜੇ ਤੇੜੇ ਪਤਾ ਕਰ ਲੈਂਦੇ ਕਿਤੇ ਹਮ ਹੋਵੇਗਾ ਕੋਈ ਵਧੀਆ ਮਿਲ ਜੂਗਾ ਆਪਾਂ ਨੂੰ ਕਿੰਨਾਂ ਕੁ ਕਿੰਨਾਂ ਖਰਚਾ ਆ ਜੂਗਾ ਹਾਂ ਚਲ ਉਹ ਤਾਂ ਆਪਾਂ ਇਕੱਠੇ ਕਰ ਲਾਂਗੇ ਦੋਏ ਜਾਣੇ ਦੋ ਜਾਣੇ ਆ ਜਦ ਰੋਟੀ ਪੈਂਦੀ ਫਿਰ ਆਪਾਂ ਗੱਲ ਗੁੱਲ ਕਰ ਲਾਂਗੇ ਸਾਰੇ ਕਿਤੇ ਹਾਂ ਫਿਰ ਆਪਾਂ ਸ਼ਿਫਟ ਹੋ ਜਾਂਗੇ ਜਲਦੀ ਹਾਂ ਚੱਲ ਚੱਲ ਫਿਰ ਆ ਹਾਂ ਚੱਲ ਕੱਲ੍ਹ ਨੂੰ ਮਿਲਦੇ ਹਾਂ ਫਿਰ ਆਪਾਂ ਹਾਂ ਫਿਰ ਦੇਖਣ ਚਲਦੇ ਹਾਂ ਕਿਤੇ ਪੀਜੀ ਹਾਂ ਠੀਕ